ਅਠਾਈ ਫਰਵਰੀ ਉੱਨੀ ਸੌ ਚੁਰਾਸੀ ਬਾਰ੍ਹਾਂ ਜਨਵਰੀ ਉੱਨੀ ਸੌ ਪਚਾਸੀ ਪੰਦਰ੍ਹਾਂ ਅਗਸਤ ਉੱਨੀ ਸੌ ਛਿਆਸੀ ਸੋਲ੍ਹਾਂ ਅਗਸਤ ਉੱਨੀ ਸੌ ਸਤਾਸੀ ਅਠਾਰ੍ਹਾਂ ਨਵੰਬਰ ਉੱਨੀ ਸੌ ਉਣਾਨਵੇਂ